ਹੈਲੋ ਸਤਿ ਸ਼੍ਰੀ ਅਕਾਲ ਜੀ ਅਸੀਂ ਨਾ ਜੀ ਨਵਨੀਤ ਫੂਡ ਬਲੌਗਰ ਤੋਂ ਬੋਲਦੇ ਹਾਂ ਅਤੇ ਸਾਨੂੰ ਨਾ ਪੰਜਾਬ ਦੇ ਫੂਡ ਕੋਰਟਾਂ ਬਾਰੇ ਤੁਸੀਂ ਦੱਸ ਸਕਦੇ ਹੋ ਕੁਝ ਫੂਡ ਬਾਰੇ ਕਿਉਂਕਿ ਮੈਂ ਬਾਹਰ ਤੋਂ ਆਈ ਹਾਂ ਅਤੇ ਮੈਂ ਇਹਦਾ ਇੱਕ ਬਲੋਗ ਬਣਾਉਣਾ ਹੈ ਅੱਛਾ ਜੀ ਠੀਕ ਠੀਕ ਹੈ ਜੀ ਅਤੇ ਮੈਨੂੰ ਤੁਸੀਂ ਕੋਈ ਫੇਮਸ ਰੈਸਟੋਰੈਂਟ ਵਗੈਰਾ ਦੱਸ ਸਕਦੇ ਹੋ ਜਿੱਥੇ ਕਿ ਇਹ ਬਹੁਤ ਜ਼ਿਆਦਾ ਵਧੀਆ ਮਿਲਦੇ ਹੋਣ ਇਹ ਸਾਰੀਆਂ ਚੀਜ਼ਾਂ ਠੀਕ ਹੈ ਜੀ ਅਤੇ ਫੇਰ ਮੈਂ ਇੱਕ ਬਲੋਗ ਬਣਾਉਣਾ ਇਹਨਾਂ ਸਾਰੀ ਚੀਜ਼ਾਂ ਦਾ ਅਤੇ ਖਾਣ ਪੀਣ 'ਚ ਕਿੱਦਾਂ ਹੁੰਦੀਆਂ ਨੇ ਇਹ ਸਾਰੀਆਂ ਚੀਜ਼ਾਂ ਠੀਕ ਹੈ ਜੀ ਵਧੀਆ ਹੋਣਗੀਆਂ ਚੀਜ਼ਾਂ ਠੀਕ ਹੈ ਜੀ ਠੀਕ ਹੈ ਅਤੇ ਜਿਹੜਾ ਰੈਸਟੋਰੈਂਟ ਹੈ ਉਹ ਕਿੱਥੋਂ ਤੱਕ ਮਿਲਜੂ ਵੀ ਜਿਹੜਾ ਰੈਸਟੋਰੈਂਟ ਹੈ ਉਹ ਸਾਨੂੰ ਕਿੱਥੇ ਮਿਲੇਗਾ ਠੀਕ ਹੈ ਅਤੇ ਅਤੇ ਪੈਸੇ ਮਤਲਬ ਫੀਸ ਵਗੈਰਾ ਚਾਰਜਿਸ ਵਗੈਰਾ ਹੁੰਦੇ ਨੇ ਜੋ ਖਾਣ ਪੀਣ 'ਤੇ ਕਿੰਨੇ ਕੁ ਲੱਗਦੇ ਨੇ ਠੀਕ ਹੈ ਜੀ ਓਕੇ ਜੀ ਓਕੇ ਠੀਕ ਹੈ ਜੀ ਓਕੇ ਹੈ